ਤੁਸੀਂ ਜੀ ਅਖਬਾਰ 'ਚ ਇਸ਼ਤਿਹਾਰ ਦਿੱਤਾ ਸੀ ਕੰਮ ਵਾਸਤੇ ਠੀਕ ਹ ਜੀ ਮੈਂ ਜੀ ਦੱਸ ਪੜੀ ਆ ਆਪਣੇ ਹੰਡਾਏ ਤੋਂ ਈ ਪੜੇ ਆ ਜੀ ਹਾਂਜੀ ਹਾਂਜੀ ਸਕੂਲ 'ਚ ਵੀ ਕੰਮ ਕਰਿਆ ਜੀ ਮੈਂ ਮਿਲ ਚ ਵੀ ਕੰਮ ਕਰਿਆ

ਮੈਂ ਜੀ ਦਸ ਪੰਦਰਾਂ ਸਾਲ ਕਰ ਲਿਆ ਹਾਂਜੀ ਹਾਂਜੀ ਸਕੂਲ 'ਚ ਕਰਿਆ ਜੀ ਮਿਲ ਚ ਕੰਮ ਕਰਿਆ ਅਗਾ ਮਿਲ 'ਚ ਹੋ ਗਏ ਜੀ ਪੰਦਰਾਂ ਵੀਹ ਸਾਲ

ਦੱਸੋ ਜੀ ਤੁਸੀਂ ਹੁਣ ਰੱਖਣਾ ਚਾਹੁੰਦੇ ਹੋ ਮੈਂ ਜੀ ਸਕੂਲ 'ਚ ਕੰਮ ਕਰਿਆ ਬੱਚਿਆਂ ਕੋਲੇ ਤੇ ਪਹਿਲਾਂ ਕਿੰਨੀ ਦੇ ਸਕਦੇ ਹੋ ਦੱਸੋ ਠੀਕ ਆ ਤੇ ਭਾਅ ਜੀ ਕੰਮ ਦੇਖਿਆ ਜਾਊਗਾ ਫਿਰ ਕੰਮ ਦੇਖ ਕੇ ਤੁਹਾਨੂੰ ਦੱਸ ਦਿਆਂਗੇ ਠੀਕ ਹ ਜੀ ਠੀਕ ਹ ਜੀ ਅੱਛਾ ਜੀ ਕੈ ਕ ਵਜੇ ਆਈਏ ਜੀ ਟਾਈਮ ਦੇ ਦੋ ਠੀਕ ਆ ਜੀ ਦਸ ਵਜੇ ਆ ਜਾਂਗੇ ਹਾਂ ਫਿਰ ਸਾਨੂੰ ਕੰਮ ਦੱਸਦੀਓ ਅਸੀਂ ਕੰਮ ਦੇਖ ਲਾਂਗੇ

ਅੱਛਾ ਜੀ ਠੀਕ ਹ ਜੀ ਹੋਰ ਆਧਾਰ ਕਾਰਡ ਹੋਰ ਕੋਈ ਠੀਕ ਆ ਜੀ ਸਾਰਾ ਡਰੈਸ ਲਿਆਵਾਂਗੇ ਠੀਕ ਆ ਜੀ ਠੀਕ ਆ ਜੀ ਠੀਕ ਹ ਜੀ ਅੱਛਾ ਜੀ ਠੀਕ ਹੈ ਜੀ